ਸਿਰ ਦਰਦ ਇੱਕ ਆਮ ਬਿਮਾਰੀ ਹੈ ਜੋ ਕਿ ਹਰੇਕ ਇਨਸਾਨ ਨੂੰ ਹੋ ਜਾਂਦੀ ਹੈ ਇਹ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈ ਅਤੇ ਅਕਸਰ ਇਹੀ ਲੋਕ ਇਹ ਕਹਿ ਦਿੰਦੇ ਨੇ ਕਿ ਅੱਜ ਮੇਰਾ ਸਿਰ ਦਰਦ ਕਰ ਰਿਹਾ ਸੋ ਇਸ ਦੇ ਲਈ ਕੋਈ ਜ਼ਿਆਦਾ ਘਬਰਾਉਣ ਵਾਲੀ ਲੋੜ ਨਹੀਂ ਇਨਸਾਨ ਜਦੋਂ ਵੀ ਕੋਈ ਥੱਕਿਆ ਹਾਰਿਆ ਹੁੰਦਾ ਜਾਂ ਬਿਮਾਰ ਹੁੰਦਾ ਜਾਂ ਕਿਸੇ ਕੰਮ ਨੂੰ ਮਤਲਬ ਟੈਨਸ਼ਨ ਵਾਲੇ ਤਰੀਕੇ ਦੇ ਨਾਲ ਲੈਂਦਾ ਤਾਂ ਸਰੀਰ ਦੇ ਉੱਪਰ ਬਰਡਨ ਰਹਿੰਦਾ ਤਾਂ ਅਕਸਰ ਹੀ ਜਿਹੜਾ ਸਿਰ ਦਰਦ ਆ ਉਹ ਸਿਰ ਦਰਦ ਕਰਨ ਲੱਗ ਜਾਂਦਾ ਅਤੇ ਇਸ ਤੋਂ ਬਹੁਤਾ ਘਬਰਾਉਣ ਦੀ ਲੋੜ ਨਹੀਂ ਇਸ ਦੇ ਲਈ ਮਤਲਬ ਆਮ ਹੀ ਘਰੇਲੂ ਨੁਕਸੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਜਿਵੇਂ ਕਿ ਘਰਾਂ ਦੇ ਵਿੱਚ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ ਉਹ ਅਕਸਰ ਜੇਕਰ ਸਿਰ ਦਰਦ ਕਰਨ ਲੱਗ ਜੇ ਤਾਂ ਗਰਮ ਪਾਣੀ ਦੀ ਜਿਹੜੀ ਟਕੋਰ ਆ ਉਹ ਕਰ ਲੈਂਦੇ ਨੇ ਸੇਕਾ ਦੇ ਲੈਂਦੇ ਨੇ ਗਰਮ ਪਾਣੀ ਨਾਲ ਅਤੇ ਇਸ ਦੇ ਲਈ ਹੋਰ ਵੀ ਕ ਬਹੁਤ ਸਾਰੇ ਨੁਕਸੇ ਜਿਹੜੇ ਅਪਣਾਏ ਜਾਂਦੇ ਨੇ ਜਿਵੇਂ ਪੁਦੀਨੇ ਦੇ ਪੱਤਿਆਂ ਨੂੰ ਜਿਹੜਾ ਉਬਾਲ ਕੇ ਉਸ ਦਾ ਕਾੜ੍ਹਾ ਬਣਾ ਕੇ ਜਿਹੜਾ ਅਕਸਰ ਪੀਤਾ ਜਾਂਦਾ ਤਾਂ ਉਹਦੇ ਨਾਲ ਵੀ ਸਿਰ ਦਰਦ ਆ ਜਿਹੜਾ ਉਹ ਆਰਾਮ ਰਹਿੰਦਾ ਨਿੰਬੂ ਜਿਹੜੇ ਦਾ ਤੇਲ ਨਿੰਬੂ ਦੇ ਤੇਲ ਦੇ ਨਾਲ ਸਿਰ ਦੇ ਵਿੱਚ ਮਾਲਸ਼ ਕਰਨ ਦੇ ਨਾਲ ਵੀ ਜਿਹੜਾ ਸਿਰ ਦਰਦ ਹੈਗਾ ਉਹ ਅਕਸਰ ਠੀਕ ਹੋ ਜਾਂਦਾ ਗਾ ਇਹ ਪਿੰਡਾਂ ਦੇ ਘਰੇਲੂ ਨੁਕਸੇ ਹਨ ਹੋਰ ਵੀ ਜਿਵੇਂ ਜੇਕਰ ਅਸੀਂ ਤੁਲਸੀ ਦੇ ਪੱਤਿਆਂ ਦਾ ਵੀ ਕਾੜ੍ਹਾ ਬਣਾ ਲਈਏ ਉਸ ਨੂੰ ਉਬਾਲ ਕੇ ਉਸਦਾ ਪਾਣੀ ਜਿਹੜਾ ਰਸ ਹੁੰਦਾ ਮਤਲਬ ਉਸਦਾ ਤਾਂ ਉਹ ਪੀਣ ਦੇ ਨਾਲ ਵੀ ਹੈ ਜਿਹੜਾ ਸਿਰ ਦਰਦ ਆ ਮਤਲਬ ਠੀਕ ਹੋ ਜਾਂਦਾ ਉਹ ਜਿਵੇਂ ਅਜਵਾਇਨ ਦੀ ਜੇਕਰ ਅਜਵਾਇਨ ਨੂੰ ਚਾਹ ਦੇ ਵਿੱਚ ਉਬਾਲ ਕੇ ਪੀਤਾ ਜਾਵੇ ਤਾਂ ਉਹ ਵੀ ਜਿਹੜਾ ਸਿਰ ਦਰਦ ਲਈ ਬਹੁਤ ਆਰਾਮਦਾਇਕ ਰਹਿੰਦਾ ਅਤੇ ਬਹੁਤ ਹੀ ਆਰਾਮ ਦਿੰਦਾ ਗਰਮ ਦੁੱਧ ਦੇ ਵਿੱਚ ਜੇਕਰ ਅਸੀਂ ਈਲਾਚੀ ਨੂੰ ਵੀ ਉਬਾਲ ਲਈਏ ਅਤੇ ਉਹ ਵੀ ਮਤਲਬ ਬਹੁਤ ਫਾਇਦੇਮੰਦ ਰਹਿੰਦਾ ਦੇ ਇਸ ਦੇ ਨਾਲ ਕਈ ਲੋਕ ਸਿਰ ਦੀ ਮਾਲਸ਼ ਕਰਵਾਉਂਦੇ ਨੇਗੇ ਜਿਵੇਂ ਨਿੰਬੂ ਦੇ ਤੇਲ ਦੇ ਨਾਲ ਜੇਕਰ ਮਾਲਸ਼ ਕਰੀਏ ਤਾਂ ਉਹ ਦ ਸਿਰ ਦਰਦ ਆ ਜਿਹੜਾ ਬਹੁਤ ਘੱਟ ਜਾਂਦਾ ਅਤੇ ਹੋਰ ਵੀ ਜੇਕਰ ਜਿਵੇਂ ਸਿਰ ਦਰਦ ਦੇ ਲਈ ਕਾਫੀ ਘਰੇਲੂ ਨੁਕਸੇ ਨੇਗੇ ਜਿਵੇਂ ਜਾਂ ਫਿਰ ਆਯੂਰਵੈਦਿਕ ਦਵਾਈਆਂ ਵੀ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਵੀ ਜਿਹੜੀਆਂ ਸਿਰ ਦਰਦ ਦੇ ਵਿੱਚ ਲਾਭਦਾਇਕ ਹੁੰਦੀਆਂ ਨੇਗੀਆਂ ਅਤੇ ਅਕਸਰ ਹੀ ਲੋਕ ਸਿਰ ਦਰਦ ਦਾ ਬਹੁਤ ਜ਼ਿਆਦਾ ਉਹ ਜਿਵੇਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਅਕਸਰ ਹੀ ਅਸੀਂ ਲੋਕਾਂ ਨੂੰ ਦੇਖਦੇ ਹਾਂ ਕਿ ਉਹ ਸਿਰ ਦਰਦ ਦੇ ਉਹ ਕਰਦੇ ਨੇਗੇ